ਸਾਡੇ ਪੰਜਾਬ ਵਿੱਚ ਤਿੰਨ ਸ਼ਹਿਰ ਚੰਡੀਗੜ੍ਹ ਅੰਬਰਸਰ ਅਤੇ ਲੁਧਿਆਣਾ ਬਹੁਤ ਹੀ ਪ੍ਰਸਿੱਧ ਸ਼ਹਿਰ ਕਹਾਉਂਦੇ ਹਨ ਚੰਡੀਗੜ੍ਹ ਆਪਣੀ ਖੂਬਸੂਰਤੀ ਲਈ ਬਹੁਤ ਪ੍ਰਸਿੱਧ ਹੈ ਅਤੇ ਜੋ ਅੰਬਰਸਰ ਹੈ ਉੱਥੇ ਦੀਆਂ ਜੁੱਤੀਆਂ ਸੂਟ ਅਤੇ ਦਰਬਾਰ ਸਾਹਿਬ ਕਰਕੇ ਉਹ ਸ਼ਹਿਰ ਬਹੁਤ ਹੀ ਪ੍ਰਸਿੱਧ ਅਤੇ ਸੋਹਣਾ ਮੰਨਿਆ ਜਾਂਦਾ ਹੈ ਅਤੇ ਲੁਧਿਆਣਾ ਸ਼ਹਿਰ ਉੱਥੇ ਜੋ ਸਮਾਨ ਹੈ ਸੂਟ ਜੁੱਤੀਆਂ ਮੇਕਅਪ ਦਾ ਸਮਾਨ ਬਹੁਤ ਹੀ ਸਸਤਾ ਮਿਲਦਾ ਹੈ ਜੋ ਲੋਕ ਉੱਥੇ ਖਰੀਦਣ ਜਾਂਦੇ ਹਨ